ਨਿਊਜ਼ ਮੀਡੀਆ ਪਿੰਡਾਂ ਵੱਲ ਧਿਆਨ ਨਹੀਂ ਦਿੰਦੀ ਉੱਥੇ ਦੀਆਂ ਸੜਕਾਂ ਟੁੱਟੀਆਂ ਹੋਈਆਂ ਹਨ ਅਤੇ ਵ ਸ਼ਹਿਰਾਂ ਵੱਲ ਜ਼ਿਆਦਾ ਧਿਆਨ ਦਿੰਦੀ ਹੈ ਪਿੰਡਾਂ ਵਿੱਚ ਵੀ ਧਿਆਨ ਦੇਣਾ ਚਾਹੀਦਾ ਹੈ ਮੀ ਨਿਊਜ਼ ਮੀਡੀਆ ਵਿੱਚ ਗੱਲਾਂ ਬਹੁਤ ਕੀਤੀਆਂ ਜਾਂਦੀਆਂ ਹਨ ਪਰ ਸ਼ਹਿਰਾਂ ਪਿੰਡਾਂ ਬਾਰੇ ਕੋਈ ਵੀ ਨਹੀਂ ਬੋਲਦਾ ਪਿੰਡਾਂ ਬਾਰੇ ਵੀ ਬੋਲਣਾ ਚਾਹੀਦਾ ਹੈ ਕਿ ਉੱਥੇ ਦੀ ਉੱਥੇ ਦੀ ਖੇਤੀਬਾੜੀ ਬਾਰੇ ਵੀ ਬੋਲਣਾ ਚਾਹੀਦਾ ਹੈ ਜਿੱਥੋਂ ਸਾਨੂੰ ਸਭ ਕੁਛ ਮਿਲਦਾ ਹੈ ਖਾਣ ਨੂੰ ਕਣਕ ਅਤੇ ਹੋਰ ਚੀਜ਼ਾਂ ਵੀ ਮਿਲਦੀਆਂ ਹਨ ਅਤੇ ਸਾਨੂੰ ਉਹਦੇ ਬਾਰੇ ਵੀ ਸੋਚਣਾ ਚਾਹੀਦਾ ਹੈ ਮੀਡੀਆ ਜਿਹੜਾ ਗੱਲਾਂ ਮੀਡੀਆ ਕਰ ਸ਼ਹਿਰਾਂ ਵਿੱਚ ਸ਼ਹਿਰਾਂ ਵਿੱਚ ਸ਼ਹਿਰਾਂ ਦੀ ਆਹੀ ਗੱਲਾਂ ਦਿਖਾਉਂਦਾ ਹੈ ਜਦੋਂ ਵੀ ਹੋ ਟੈਲੀਵਿਜ਼ਨ 'ਤੇ ਦੇਖੋ ਤਾਂ ਉਹ ਮੀਡੀਆ ਸ਼ਹਿਰਾਂ ਦੀਆਂ ਹੀ ਗੱਲਾਂ ਸੁਣਾਉਂਦਾ ਹੈ ਪਿੰਡਾਂ ਦੀਆਂ ਸੜਕਾਂ ਪਿੰਡਾਂ ਵਿੱਚ ਪਾਣੀ ਦੀ ਕਮੀ ਹੋਣ ਕਰਕੇ ਉੱਥੇ ਦੀ ਖੇਤੀਬਾੜੀ ਇੰਨੀ ਵਧੀਆ ਨਹੀਂ ਹੁੰਦੀ ਸਾਨੂੰ ਕੀ ਉਹਨਾਂ ਦਾ ਧਿਆਨ ਨਹੀਂ ਰੱਖਣਾ ਚਾਹੀਦਾ ਸਾਰਿਆਂ ਨੂੰ ਉੱਧਰ ਵੀ ਧਿਆਨ ਲੋਕਾਂ ਨੂੰ ਦੇਣਾ ਚਾਹੀਦਾ ਹੈ ਕਿ ਪਿੰਡਾਂ ਵਿੱਚ ਵੀ ਪਿੰਡਾਂ ਤੋਂ ਸਾਨੂੰ ਬਹੁਤ ਕੁਛ ਮਦਦ ਮਿਲਦੀ ਹੈ ਨਿਊਜ਼ ਮੀਡੀਆ ਨੂੰ ਆਪਣੇ ਪਿੰਡਾਂ ਵਿੱਚ ਪਿੰਡਾਂ ਵਿੱਚ ਵੀ ਧਿਆਨ ਦੇਣਾ ਚਾਹੀਦਾ ਹੈ ਅਤੇ ਉਹਨਾਂ ਦੇ ਉੱਤੇ ਵੀ ਕੁਛ ਨਾ ਕੁਛ ਕਾਰਵਾਈ ਕਰਨੀ ਚਾਹੀਦੀ ਹੈ ਧੰਨਵਾਦ